ਸਤਿ ਸ਼੍ਰੀ ਅਕਾਲ ਤੁਸੀਂ ਛਾਬੜਾ ਰੈਸਟੋਰੈਂਟ ਤੋਂ ਗੱਲ ਕਰ ਰਹੇ ਹੋ ਅਸੀਂ ਸਵੀਗੀ ਐਪ ਤੋਂ ਪੀਜ਼ਾ ਓਡਰ ਕੀਤਾ ਸੀ ਜਿਸ ਦੇ ਵਿੱਚ ਤਿੰਨ ਪੀਜਾ ਸ਼ਾਮਿਲ ਸਨ ਪੀਜ਼ਾ ਬੜੀ ਮਾੜੀ ਹਾਲਤ ਵਿੱਚ ਸੀ ਪਹਿਲਾਂ ਵੀ ਅਕਸਰ ਅਸੀਂ ਆਪਣਾ ਖਾਣਾ ਮੰਗਵਾਉਂਦੇ ਰਹਿੰਦੇ ਹਾਂ ਪਰ ਕਦੇ ਵੀ ਸਾਨੂੰ ਇਸ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਇਸ ਵਾਰ ਜਿਹੜਾ ਅਸੀਂ ਓਡਰ ਕੀਤਾ ਉਹ ਓਡਰ ਸਹੀ ਢੰਗ ਨਾਲ ਨਹੀਂ ਸੀ ਆਇਆ ਉਸ ਵਿੱਚ ਪੀਜ਼ਾ ਸਹੀ ਨਹੀਂ ਆਇਆ ਜਦੋਂ ਅਸੀਂ ਭੇਜਿਆ ਗਿਆ ਪੀਜ਼ਾ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚ ਬਦਬੂ ਆ ਰਹੀ ਸੀ ਉਸ ਵਿੱਚ ਥੋੜ੍ਹੇ ਥੋੜ੍ਹੇ ਕੀੜੇ ਵੀ ਦਿਖ ਰਹੇ ਸਨ ਪੀਜ਼ਾ ਬਹੁਤ ਮੰਦੀ ਹਾਲਤ ਵਿੱਚ ਸੀ ਉਹ ਪੀਜ਼ਾ ਖਾਣ ਯੋਗ ਨਹੀਂ ਸੀ ਦੇਖਣ ਵਿੱਚ ਉਹ ਐਵੇਂ ਲੱਗਦਾ ਸੀ ਜਿਵੇਂ ਕਾਫੀ ਦਿਨ ਪੁਰਾਣਾ ਹੋਵੇ ਜਾਂ ਬੇਹਾ ਹੋਵੇ ਪੁਰਾਣਾ ਪੀਜਾ ਸੀ ਅਸੀਂ ਤੁਹਾਡੇ 'ਤੇ ਵਿਸ਼ਵਾਸ ਕਰਕੇ ਕੋਈ ਵੀ ਚੀਜ਼ ਓਡਰ ਕਰਦੇ ਹਾਂ ਤਾਂ ਸਾਨੂੰ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਅੱਗੇ ਤੋਂ ਇਸ ਤਰ੍ਹਾਂ ਦੀਆਂ ਦਿੱਕਤਾਂ ਦਾ ਧਿਆਨ ਰੱਖਿਆ ਜਾਵੇ ਲੋਕ ਤੁਹਾਡੇ 'ਤੇ ਬਹੁਤ ਭਰੋਸਾ ਕਰਕੇ ਕੁਝ ਨਾ ਕੁਝ ਖਾਣ ਨੂੰ ਔਡਰ ਕਰਦੇ ਹਨ ਅਤੇ ਤੁਹਾਡਾ ਪੂਰਾ ਫਰਜ਼ ਬਣਦਾ ਹੈ ਕਿ ਤੁਹਾਨੂੰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਜਿਹੜਾ ਵੀ ਤੁਸੀਂ ਓਡਰ ਭੇਜੋ ਖਾਣੇ ਦਾ ਚਾਹੇ ਕੁਛ ਵੀ ਹੋਰ ਹੋਵੇ ਖਾਣਾ ਪੂਰਾ ਸ਼ੁੱਧ ਸਾਫ ਸੁਥਰਾ ਭੇਜਿਆ ਜਾਵੇ ਜਾਂ ਫਿਰ ਲੋਕ ਵੀ ਤੁਹਾਡਾ ਔਡਰ ਪ੍ਰਾਪਤ ਕਰਕੇ ਬਹੁਤ ਹੀ ਖੁਸ਼ ਹੋਣ ਧੰਨਵਾਦ